ਮੌਸਮ ਅਤੇ ਮੌਕੇ ਦੇ ਲਿਹਾਜ ਨਾਲ ਸੈਲਾਨੀਆਂ ਲਈ ਸਾਡੇ ਸਥਾਨ ਦਾ ਦੌਰਾ ਕਰਨ ਦਾ ਸਮਾਂ ਅਕਤੂਬਰ ਅਤੇ ਨਵੰਬਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਇੱਥੇ ਮੌਸਮ ਬਹੁਤ ਵਧੀਆ ਹੁੰਦਾ ਹੈ ਨਾ ਹੀ ਬਹੁਤ ਠੰਡ ਹੁੰਦੀ ਅਤੇ ਨਾ ਹੀ ਗਰਮੀ ਅਤੇ ਇਹਨਾਂ ਮਹੀਨਿਆਂ ਨੂੰ ਤਿਉਹਾਰ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ ਕਿਉਂਕਿ ਤਿਉਹਾਰ ਬਹੁਤ ਹੁੰਦੇ ਹਨ ਇਹਨਾਂ ਵਿੱਚ ਦਿਵਾਲੀ ਪ੍ਰਮੁੱਖ ਹੈ ਅਤੇ ਧਾਰਮਿਕ ਮੇਲੇ ਵੀ ਲਗਦੇ ਹਨ ਜਿੱਥੇ ਅਲੱਗ ਅਲੱਗ ਥਾਵਾਂ ਤੋਂ ਲੋਕ ਇਹਨਾਂ ਨੂੰ ਦੇਖਣ ਆਉਂਦੇ ਹਨ